ਪੰਜਾਬੀ ਭਾਸ਼ਾ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਹ ਬਹੁਤ ਹੀ ਸਦੀਆਂ ਤੋਂ ਚੱਲੀ ਆ ਰਹੀ ਹੈ ਸਾਡੇ ਗੁਰੂ ਪੀਰਾਂ ਨੇ ਵੀ ਇਹੀ ਭਾਸ਼ਾ ਨੂੰ ਮਾਨਿਅਤਾ ਦਿੱਤੀ ਸੀ ਅਤੇ ਇਹੀ ਭਾਸ਼ਾ ਵਿੱਚ ਕਈ ਗ੍ਰੰਥ ਵੀ ਲਿਖੇ ਸੀਗੇ ਇਹ ਭਾਸ਼ਾ ਹੀ ਬਹੁਤ ਪੁਰਾਣੀ ਹੈ ਅਤੇ ਮੈਂ ਪੰਜਾਬ ਤੋਂ ਹੀ ਬਿਲੋਂਗ ਕਰਦੀ ਹਾਂ ਤਾਂ ਮੇਰੀ ਪਹਿਲੀ ਭਾਸ਼ਾ ਤਾਂ ਪੰਜਾਬੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਕਈ ਕਈ ਦ ਰਾ ਪੰਜਾਬ ਦੇ ਰਾਜਾਂ ਵਿੱਚ ਕਈ ਕਈ ਤਰੀਕਿਆਂ ਨਾਲ ਪੰਜਾਬੀ ਬੋਲੀ ਜਾਂਦੀ ਹੈ ਜਿਵੇਂ ਕਿ ਪੋਠੋਹਾਰੀ ਮੁਲਤਾਨੀ ਮਲਵਈ ਅਤੇ ਕ ਹੋਰ ਵੀ ਕਈ ਹੁੰਦੇ ਨੇ ਜਿਨ੍ਹਾਂ ਅਲੱਗ ਅਲੱਗ ਤਰੀਕੇ ਹੁੰਦੇ ਨੇ ਜਿਹਨਾਂ ਵਿੱਚ ਪੰਜਾਬੀ ਅਲੱਗ ਅਲੱਗ ਤਰੀਕਿਆਂ ਨਾਲ ਬੋਲੀ ਜਾਂਦੀ ਹੈ